ਹਾਂ ਟੈਕਨੋਲੋਜੀ ਨੇ ਸਾਡੀ ਡਾਕਟਰੀ ਲੋੜਾਂ ਨੂੰ ਬਹੁਤ ਹੀ ਮਦਦਗਾਰ ਸਾਬਤ ਕੀਤਾ ਹੈ ਕਿਉਂਕਿ ਜਿਵੇਂ ਕਿ ਕਰੋਨਾ ਕਾਲ ਸੀ ਉਸ ਕਰੋਨਾ ਕਾਲ ਦੇ ਵਿੱਚ ਸਾਰਾ ਕੁਝ ਆਨਲਾਈਨ ਸੀ ਤਾਂ ਡਾਕਟਰਾਂ ਤੱਕ ਪਹੁੰਚਣਾ ਵੀ ਆਨਲਾਈਨ ਹੀ ਹੋ ਗਿਆ ਡਾਕਟਰਾਂ ਨੇ ਸਾਨੂੰ ਆਨਲਾਈਨ ਸਲਾਹ ਦਿੱਤੀ ਔਨਲਾਈਨ ਹੀ ਸਾਡੇ ਕੋਲ ਦਵਾਈਆਂ ਵੀ ਪਹੁੰਚੀਆਂ ਕਿਉਂਕਿ ਇੱਕ ਦੂਸਰੇ ਨਾਲ ਰਾਬਤਾ ਹੋਣਾ ਮੁਸ਼ਕਲ ਸੀਗਾ ਠੀਕ ਜਿਹੜੇ ਲੋਕ ਬਜ਼ੁਰਗ ਨੇ ਉਹ ਬਾਹਰ ਬੱਚੇ ਗਏ ਹੋਏ ਨੇ ਕਿਵੇਂ ਡਾਕਟਰ ਕੋਲ ਜਾਣਗੇ ਉਨ੍ਹਾਂ ਲਈ ਔਨਲਾਈਨ ਰੱਬ ਦੀ ਤਰ੍ਹਾਂ ਸਾਬਤ ਹੋਇਆ ਹੈ ਡ ਉਨ੍ਹਾਂ ਕੋਲ ਡਾਕਟਰ ਤੱਕ ਪਹੁੰਚ ਡਾਕਟਰ ਨਾਲ ਗੱਲਬਾਤ ਔਨਲਾਈਨ ਤਾਂ ਔਨਲਾਈਨ ਦਵਾਈਆਂ ਵੀ ਆ ਜਾਂਦੀਆਂ ਨੇ ਠੀਕ ਹੈ ਤਾਂ ਨਾਲ ਹੀ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਸਾਡੇ ਨੇੜੇ ਤੇੜੇ ਕਿਹੜਾ ਡਾਕਟਰ ਹੈ ਉਹ ਕਿਸ ਚੀਜ਼ ਦਾ ਸਪੇਸ਼ਿਲਿਸਟ ਹੈ ਤਾਂ ਉਹ ਕਿੰਨੇ ਤੋਂ ਕਿੰਨੇ ਸਾਨੂੰ ਮਿਲਦਾ ਸਾਰਾ ਕੁਝ ਸਾਨੂੰ ਔਨਲਾਈਨ ਪਤਾ ਲੱਗ ਜਾਂਦਾ ਸਾਨੂੰ ਉਸ ਤੱਕ ਪੁੱਜਣ ਦੀ ਲੋੜ ਹੀ ਨਹੀਂ ਪੈਂਦੀ ਆ